ਖਾਸ ਤੌਰ ਤੇ ਹੋਰ ਮਾਸ਼ਪੇਸ਼ੀਆਂ ਨੂੰ ਮਜਬੂਤ ਬਣਾਉਂਦਾ ਹੈ ਬਿਹਤਰ ਮੁਦਰਾ ਅਤੇ ਅਲਾਈਨਮੈਂਟ ਨੂੰ ਉਤਸ਼ਾਹਿਤ ਕਰਦਾ ਹੈ ਜੋ ਲੰਮੇ ਸਮੇਂ ਦੇ ਦਰਦ ਨੂੰ ਘੱਟ ਕਰ ਸਕਦਾ ਹੈ ਖਾਸ ਕਰਕੇ ਪਿੱਠ ਦਰਦ ਗਰਦਨ ਅਤੇ ਮੋਢਿਆਂ ਵਿੱਚ ਦਰਦ ਅਭਿਆਸ ਨਿਯੰਤਰਿਤ ਸਾਹ ਲੈਣ ਦੇ ਅਭਿਆਸਾ ਦੁਆਰਾ ਸਰਕੂਲੇਸ਼ਨ ਵਿੱਚ ਸੁਧਾਰ ਅਤੇ ਫੇਫੜਿਆਂ ਦੀ ਇੱਕ ਬਿਹਤਰ ਸਮਰੱਥਾ ਨੂੰ ਉਤਸ਼ਾਹਿਤ ਕਰਕੇ ਕਾਰਡੀਓ ਸਿਹਤ ਨੂੰ ਵੀ ਵਧਾਉਂਦਾ ਹੈ ਇਸ ਤੋਂ ਇਲਾਵਾ ਯੋਗਾ ਲਿਫੈਕਟਿਕ ਪ੍ਰਣਾਲੀ ਨੂੰ ਉਤੇਜਿਤ ਕਰਕੇ ਆਪਣੇ ਜਹਿਰੀਲੇ ਪਦਾਰਥਾਂ ਨੂੰ ਹਟਾਉਣ ਦੀ ਸਰੀਰ ਦੀ ਕੁਦਰਤੀ ਯੋਗਤਾ ਨੂੰ ਵਧਾ ਕੇ ਪ੍ਰਕਿਰਿਆ ਵਿੱਚ ਸਹਾਇਤਾ ਕਰਦਾ ਹੈ ਮਾਨਸਿਕ ਤੌਰ ਤੇ ਯੋਗਾ ਤਣਾਅ ਅਤੇ ਚਿੰਤਾ ਦੇ ਪੱਧਰਾਂ ਨੂੰ ਮਹੱਤਵਪੂਰਨ ਤੌਰ ਤੇ ਘਟਾਉਂਦੇ ਹੋਏ ਅਰਾਮ ਅਤੇ ਦਿਮਾਗ ਦੀ ਸਥਿਤੀ ਵਿੱਚ ਉਤਸ਼ਾਹਿਤ ਕਰਦਾ ਹੈ ਅਭਿਆਸ ਮੌਜੂਦਾ ਪਾਲ ਦੀ ਇੱਕ ਸੁਚੇਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਦਾ ਹੈ ਜੋ ਇਕਾਗਰਤਾ ਅਤੇ ਬੋਦਾਤਮਕ ਕਾਰਜਾਂ ਨੂੰ ਸੁਧਾਰ ਕਰਦਾ ਹੈ ਇਹ ਮਾਨਸਿਕ ਵਧੀ ਹੋਈ ਭਾਵਨਾਤਾ ਲਚਕਤਾ ਵੱਲ ਲੈ ਜਾ ਸਕਦੀ ਹੈ ਪ੍ਰੈਕਟੀਸ਼ਨਰਾਂ ਨੂੰ ਵਧੇਰੇ ਆਸਾਨੀ ਅਤੇ ਭਾਵਨਾਤਮਕ ਸੰਤੁਲਨ ਨਾਲ ਚੁਣੌਤੀਆਂ ਨੂੰ ਨੈਗੇਟਿਵ ਕਰਨ ਵਿੱਚ ਮਦਦ ਕਰਦੀ ਹੈ ਨਿਯਮਤ ਯੋਗਾ ਅਭਿਆਸ ਨੂੰ ਨੀਂਦ ਆਉਣ ਗੁਣਵੱਤਾ ਵਿੱਚ ਵਾਧਾ ਕੀਤਾ ਜਾਂਦਾ ਹੈ ਕਿਉਂਕਿ ਇਹ ਸਰੀਰ ਦੇ ਤਨਾਅ ਪ੍ਰਤੀਕਿਰਿਆ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਹ ਆਰਾਮਦਾਇਕ ਸਥਿਤੀ ਨੂੰ ਉਤਸ਼ਾਹਿਤ ਕਰਦਾ ਹੈ ਇਸ ਤੋਂ ਇਲਾਵਾ ਯੋਗਾ ਦੇ ਧਿਆਨ ਦੇ ਪਹਿਲੂ ਸਵੈ ਪ੍ਰਤੀਬਿੰਬ ਅਤੇ ਵਿਅਕਤੀਗਤ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ ਆਪਣੇ ਆਪ ਨਾਲ ਡੂੰਘੇ ਸੰਬੰਧ ਅਤੇ ਅੰਦਰੂਨੀ ਸ਼ਾਂਤੀ ਦੀ ਉੱਚੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ